ਭਾਰਤ ਵਿੱਚ ਨੱਬੇ ਪ੍ਰਤੀਸ਼ਤ ਲੋਕ ਜੋ ਚਾਹ ਨੂੰ ਬਹੁਤ ਪਸੰਦ ਕਰਦੇ ਹਨ ਭਾਰਤ ਵਿੱਚ ਵੱਖ ਵੱਖ ਤਰ੍ਹਾਂ ਦੀ ਚਾਹ ਪੀਤੀ ਜਾਂਦੀ ਹੈ ਲੈਮਨ ਟੀ ਗੁੜ ਵਾਲੀ ਚਾਹ ਗਰੀਨ ਟੀ ਬਲੈਕ ਟੀ ਸੁੰਡ ਵਾਲੀ ਚਾਹ ਇਲਾਚੀ ਵਾਲੀ ਚਾਹ ਦੁੱਧ ਵਾਲੀ ਚਾਹ ਅਦਰਕ ਵਾਲੀ ਚਾਹ ਦੁੱਧ ਵਿੱਚ ਪੱਤੀ ਵਾਲੀ ਚਾਹ ਬਹੁਤ ਪਸੰਦ ਕੀਤੀ ਜਾਂਦੀ ਹੈ ਵੱਖ ਵੱਖ ਤਰ੍ਹਾਂ ਦੀ ਵੱਖ ਵੱਖ ਦੇਸ਼ਾਂ ਦੀ ਚਾਹ ਜੋ ਕਿ ਭਾਰਤ ਵਿੱਚ ਬਣਾਈ ਜਾਂਦੀ ਹੈ ਸਾਡੇ ਘਰ ਵੀ ਦੋ ਤਰ੍ਹਾਂ ਦੀ ਚਾਹ ਬਣਦੀ ਹੈ ਜੋ ਕਿ ਇੱਕ ਦੁੱਧ ਵਾਲੀ ਅਤੇ ਇੱਕ ਗੁੜ ਵਾਲੀ ਹੈ ਚਾਹ ਬਹੁਤ ਹੀ ਜ਼ਿਆਦਾ ਭਾਰਤ ਵਿੱਚ ਲੋਕ ਪਸੰਦ ਕਰਦੇ ਹਨ ਭਾਰਤੀ ਲੋਕਾਂ ਨੂੰ ਚਾਹ ਪੀਣਾ ਬਹੁਤ ਹੀ ਚੰਗਾ ਲੱਗਦਾ ਹੈ ਭਾਰਤ ਵਿੱਚ ਲੋਕ ਲੰਗਰ ਵੀ ਚਾਹ ਦਾ ਲਾਉਂਦੇ ਹਨ ਲੋਕ ਇਸ ਨੂੰ ਪੀਣਾ ਬਹੁਤ ਪਸੰਦ ਕਰਦੇ ਹਨ ਜੇ ਕੋਈ ਪਰਾਹੁਣਾ ਕਿਸੇ ਦੇ ਘਰ ਜਾਂਦਾ ਹੈ ਤਾਂ ਉਹ ਉਸਨੂੰ ਬਿਨਾ ਚਾਹ ਪੀਤੇ ਉੱਥੋਂ ਵਾਪਸ ਨਹੀਂ ਆਉਣ ਦਿੰਦੇ ਚਾਹ ਨਾਲ ਹੀ ਸਭ ਦਾ ਮਨ ਖੁਸ਼ ਹੁੰਦਾ ਹੈ ਪੰਜਾਬੀਆਂ ਵਿੱਚ ਚਾਹ ਨੂੰ ਬਹੁਤ ਹੀ ਪ੍ਰਸਹ ਮਿਹਨ ਚੰਗਾ ਮੰਨਿਆ ਜਾਂਦਾ ਹੈ ਪੰਜਾਬੀਆਂ ਵਿੱਚ ਕਹਾਵਤ ਵੀ ਹੈ ਚਾਹ ਚੰਦਰੀ ਚਾਹ ਚੂੜੀ ਚਾਹ ਨੀਚਾਂ ਚੋਂ ਨੀਚ ਜਿੱਥੇ ਮਿਲਜੇ ਉੱਥੇ ਹੋਜੋ ਢੀਠ